ਮੈਂ ਘਰ ਦਾਲ ਭਿਓ ਕੇ ਰਗੜ ਕੇ ਬੜੀਆਂ ਬਣਾਈਆਂ ਸੀ ਜੋ ਕਿ ਉਹ ਸਹੀ ਨਹੀਂ ਬਣੀਆਂ ਫਿਰ ਉਸਨੂੰ ਵੇਸਟ ਕਰਨ ਦੀ ਬਜਾਏ ਮੈਂ ਉਸ ਨੂੰ ਦੁਬਾਰਾ ਆਲੂ ਪਾ ਕੇ ਤੜਕਾ ਲਾ ਕੇ ਸਬਜ਼ੀ ਬਣਾਈ ਬਹੁਤ ਟੇਸਟੀ ਬਣੀ